ਹਾਂਜੀ ਜੇਕਰ ਮੈਂ ਗੱਲ ਕਰਾਂ ਮੈਂ ਆਪਣੇ ਬਚਪਨ ਤੋਂ ਹੀ ਮੈਂ ਹਰਮੋਨੀਅਮ ਅਤੇ ਆਪਣਾ ਰੋਕ ਬੈਂਡ ਵਜਾਉਣ ਲਈ ਬਹੁਤ ਮੈਂ ਇੰਟ੍ਰਸਟ ਦਿਖਾਇਆ ਹੈ ਅਤੇ ਮੈਨੂੰ ਇਹ ਦੋਨੋਂ ਚੀਜ਼ਾਂ ਦੋਨੋਂ ਸਾਜ਼ ਬਹੁਤ ਤਰੀਕੇ ਨਾਲ ਵਜਾਉਣੇ ਆਉਂਦੇ ਆ ਜੇਕਰ ਮੈਂ ਗੱਲ ਕਰਾਂ ਆਪਣੇ ਸਕੂਲ ਟਾਈਮ ਤੋਂ ਵੀ ਮੈਂ ਹਰਮੋਨੀਅਮ ਅਤੇ ਰੋਕ ਬੈਂਡ ਵਜਾਉਣੇ ਸਿੱਖੇ ਹੈ ਅਤੇ ਆਪਣੇ ਮਾਸਟਰ ਤੋਂ ਮੈਂ ਇਹ ਦੋਨੋਂ ਚੀਜ਼ਾਂ ਬਹੁਤ ਚੰਗੇ ਤਰੀਕੇ ਨਾਲ ਸਿੱਖੀਆਂ ਸੀਗੀਆਂ ਮੇਰਾ ਬਚਪਨ ਤੋਂ ਹੀ ਸੀਗਾ ਕਿ ਮੈਂ ਇਹਨਾਂ ਦੋਨਾਂ ਚੀਜ਼ਾਂ 'ਚ ਐਕਸਪਰਟ ਹੋਣਾ ਹੀ ਹੈ ਅਤੇ ਅੱਜ ਵੀ ਮੈਂ ਕਹਿ ਸਕਦਾ ਕਿ ਕਿਸੇ ਹੱਦ ਤੱਕ ਮੈਂ ਉਸ ਚੀਜ਼ਾਂ 'ਤੇ ਐਕਸਪਰਟ ਹੋਇਆਹਾਂ ਅਤੇ ਫਿਰ ਵੀ ਮੇਰੇ ਅੰਦਰ ਉਸ ਚੀਜ਼ ਦੇ ਪ੍ਰਤੀ ਮੋਹ ਹੁਣ ਖ਼ਤਮ ਨਹੀਂ ਹੋਇਆ ਜੇਕਰ ਮੈਂ ਗੱਲ ਕਰਾਂ ਆਪਣੇ ਸਕੂਲ ਟਾਈਮ ਦੇ ਵਿੱਚ ਮੈਂ ਆਪਣੇ ਸਟੇਜ ਪ੍ਰਫੋਰਮੈਂਸ ਵੀ ਬਹੁਤ ਕੀਤੀਆਂ ਨੇ ਜੇਕਰ ਕੋਈ ਕਿਸੇ ਨੇ ਗਾਣਾ ਗਾਉਣਾ ਸਟੇਜ 'ਤੇ ਖੜ੍ਹੇ ਹੋ ਕੇ ਜੇਕਰ ਕੋਈ ਗਾਣਾ ਗਾਉਣਾ ਚਾਹੁੰਦਾ ਵਾ ਤਾਂ ਮੈਂ ਉਹਨੂੰ ਪਿੱਛੋਂ ਦੀ ਹਰਮੋਨੀਅਮ ਰਾਹੀਂ ਸੰਗੀਤ ਦਿੱਤਾ ਵਾ ਅਤੇ ਨਾਲੇ ਰੋਕ ਬੈਂਡ ਦੀ ਵੀ ਮੈਂ ਆਪਣੇ ਸਟੇਜ ਪ੍ਰਫੋਰਮੈਂਸਸ ਬਹੁਤ ਵਧੀਆ ਤਰੀਕੇ ਨਾਲ ਕੀਤੀਆਂ ਨੇ ਅਤੇ ਇੱਕ ਇੱਕ ਦੋ ਵਾਰ ਤਾਂ ਮੈਂ ਅਨੁਅਲ ਫ਼ੰਕਸ਼ਨ 'ਤੇ ਵੀ ਪਰਫੋਰਮ ਕੀਤਾ ਹੈ ਜੇ ਐਂਡ ਇਸ ਕਰਕੇ ਹੀ ਮੈਨੂੰ ਇੱਕ ਦੋ ਅਵਾਰਡ ਵੀ ਮਿਲੇ ਨੇ ਜੋ ਕਿ ਇੱਕ ਸੀਗਾ ਮੇਰਾ ਡਿਸਟਿਕ ਲੈਵਲ ਦਾ ਅਵਾਰਡ ਜੋ ਕਿ ਮੈਂ ਹਰਮੋਨੀਅਮ ਵਜਾ ਦੇ ਉਪਰੰਤ ਮੈਨੂੰ ਮਿਲਿਆ ਸੀਗਾ ਐਜ ਅ ਪ੍ਰਾਈਜ ਅਤੇ ਇੱਕ ਮੈਂ ਰੋਕ ਬੈਂਡ ਦੇ ਰਾਹੀਂ ਪ੍ਰਾਈਜ ਜਿੱਤਿਆ ਸੀਗਾ ਜੋ ਕਿ ਆਪਣੇ ਸਕੂਲ ਲੈਵਲ 'ਤੇ ਹੀ ਕੋਂਪੀਟੀਸ਼ਨ ਹੋਇਆ ਸੀਗਾ ਜਿਹਦੇ ਵਿੱਚ ਮੈਨੂੰ ਫਸਟ ਪੋਜੀਸ਼ਨ ਮਿਲੀ ਸੀਗੀ ਆਈ ਵਾ ਮੈਂ ਫਸਟ ਆਇਆ ਸੀਗਾ ਉਸ ਵਿੱਚ ਅਤੇ ਨਾਲੇ ਅੱਜ ਵੀ ਮੈਂ ਜੇਕਰ ਗੱਲ ਕਰਾਂ ਆਪਣੇ ਕੋਲੇਜ 'ਚ ਮੈਂ ਅੱਜ ਵੀ ਹਰਮੋਨੀਅਮ ਤੇ ਰੋਕ ਬੈਂਡ ਦੋਨੋਂ ਵਜਾਉਣੇ ਅੱਛੇ ਤਰੀਕੇ ਨਾਲ ਜਾਣਦਾ ਹਾਂ ਅਤੇ ਨਾਲੇ ਅੱਜ ਵੀ ਫ਼ੰਕਸ਼ਨਾਂ ਦੇ ਵਿੱਚ ਮੈਂ ਪਾਰਟੀਸੀਪੇਟ ਕਰਦਾ ਕਿ ਮੈਨੂੰ ਉਸ ਚੀਜ਼ ਦਾ ਮੋਹ ਮੇਰੇ ਅੰਦਰੋਂ ਖ਼ਤਮ ਨਾ ਹੋਵੇ ਮੈਂ ਅੱਜ ਵੀ ਚਾਹੁੰਦਾ ਕਿ ਮੈਂ ਹੋਰ ਵੀ ਨਵੀਆਂ ਚੀਜ਼ਾਂ ਸਿੱਖਾਂ ਜਿਵੇਂ ਕਿ ਗਿਟਾਰ ਹੋ ਗਿਆ ਅਤੇ ਨਾਲੇ ਤੂੰਬੀ ਨਾਲੇ ਹੋਰ ਵੀ ਵੱਧ ਮਿਜੂਜ਼ਿਕ ਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਨੇ ਮੈਂ ਉਹ ਸਾਰੀਆਂ ਵਜਾਉਣੀਆਂ ਸਿੱਖਣਾ ਚਾਹੁੰਨਾ ਹਾਂ ਧੰਨਵਾਦ ਜੀ